ਮੇਰਾ ਮਨ ਪਸੰਦ ਗੈਜੇਟ ਮੇਰਾ ਮੋਬਾਈਲ ਫੋਨ ਹੈ ਇਸ ਨਾਲ ਮੇਰੀ ਜ਼ਿੰਦਗੀ ਦੇ ਬਹੁਤ ਸਾਰੇ ਕੰਮ ਜਿਹੜੇ ਕਿ ਬਹੁਤ ਅਸਾਨੀ ਨਾਲ ਅਤੇ ਬਹੁਤ ਜ਼ਿਆਦਾ ਜੁੜੇ ਹੋਏ ਹਨ ਕਿਉਂਕਿ ਜਿਵੇਂ ਕਿ ਮੈਂ ਪੜ੍ਹਾਈ ਕਰਦੀ ਹਾਂ ਅਤੇ ਮੈਂ ਬੀਸੀਏ ਦੀ ਸਟੂਡੈਂਟ ਹਾਂ ਅਤੇ ਜਿਵੇਂ ਕੋਈ ਕਲਾਸ ਲੱਗਣੀ ਆ ਗਰੁੱਪਸ ਬਣੇ ਹੋਏ ਆ ਸਾਡੇ ਅਤੇ ਸਾਡੇ ਨਾਲ ਸਾਰਾ ਸਿਲੇਬਸ ਵੀ ਉਹਨਾਂ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਜਿਹੜਾ ਕਿ ਮੇਰੇ ਫੋਨ 'ਚ ਹਨ ਮੇਰੇ ਫੋਨ 'ਚ ਇੱਦਾਂ ਦੀ ਕਈ ਤਰ੍ਹਾਂ ਦੀਆਂ ਐਪਲੀਕੇਸ਼ਨਸ ਹਨ ਜਿਹਨਾਂ ਰਾਹੀਂ ਮੈਂ ਆਪਣਾ ਰੋਜ਼ਾਨਾ ਕੰਮ ਕਰਦੀ ਹਾਂ ਜਿਵੇਂ ਕਿ ਵਟਸਐਪ ਹੋ ਗਿਆ ਜਿਵੇਂ ਕਿ ਮੇਰਾ ਨੇਲਸ ਦਾ ਕੰਮ ਹੈ ਮੈਂ ਇੰਸਟਾਗ੍ਰਾਮ ਯੂਜ ਕਰਦੀ ਹਾਂ ਆਪਣਾ ਨੇਲਸ ਆਪਣੇ ਅੱਗੇ ਵਧਾਉਣ ਵਾਸਤੇ ਅਤੇ ਜਿਵੇਂ ਕਿ ਮੈਂ ਕਿਸੇ ਨੂੰ ਵੀ ਕਿਸੇ ਨਾਲ ਵੀ ਕੋਈ ਗੱਲ ਕਰਨੀ ਹੋਵੇ ਤਾਂ ਮੈਂ ਕੋਲਿੰਗ ਦਾ ਯੂਜ ਕਰਦੀ ਹਾਂ ਜਾਂ ਕਿਸੇ ਨੂੰ ਕੁਝ ਪੁੱਛਣਾ ਹੋਵੇ ਤਾਂ ਮੈਂ ਮੈਸੇਜ ਵਗੈਰਾ ਦਾ ਯੂਜ ਕਰਦੀ ਹਾਂ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜਿਵੇਂ ਕਿ ਮੈਨੂੰ ਕੋਈ ਜਗ੍ਹਾ ਲੱਭਣੀ ਹੋਵੇ ਤਾਂ ਮੈਂ ਗੂਗਲ ਮੈਪਸ ਵਗੈਰਾ ਦੇ ਕਾਫੀ ਚੀਜ਼ਾਂ ਹਨ ਜਿਹਨਾਂ ਨੂੰ ਦਾ ਯੂਜ ਕਰਕੇ ਉਹਨਾਂ ਦਾ ਲਾਭ ਚੱਕਦੀ ਹਾਂ ਹੋਰ ਵੀ ਜਿਵੇਂ ਕਈ ਚੀਜ਼ਾਂ ਮੇਰੇ ਕੋਲ ਕਾਫੀ ਕਈ ਤਰ੍ਹਾਂ ਦੇ ਐਪਸ ਫੋਨ ਵਿੱਚ ਮੌਜੂਦ ਹਨ ਜਿਹਨਾਂ ਕਰਕੇ ਮੇਰੀ ਰੋਜ਼ਾਨਾ ਜ਼ਿੰਦਗੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਕਲਦੀ ਹੈ ਅਤੇ ਮੈਨੂੰ ਹਰ ਕੰਮ ਵਾਸਤੇ ਵਿੱਚ ਬਹੁਤ ਹੀ ਜ਼ਿਆਦਾ ਲਾਭ ਮਿਲਦਾ ਹੈ ਮੇਰੇ ਇਸ ਮੋਬਾਇਲ ਫੋਨ ਕਰਕੇ ਇਹ ਮੇਰੀ ਜ਼ਿੰਦਗੀ ਦਾ ਇੱਕ ਸਭ ਤੋਂ ਅਹਿਮ ਹਿੱਸਾ ਹੀ ਬਣ ਚੁੱਕਿਆ ਹੈ ਕਿਉਂਕਿ ਅੱਜ ਕੱਲ੍ਹ ਦੇ ਜੀਵਨ ਵਿੱਚ ਕੋਈ ਵੀ ਅਦਾ ਬੰਦਾ ਨਹੀਂ ਹੋਊਗਾ ਜਿਹਦੇ ਕੋਲ ਸਮਾਰਟ ਫੋਨ ਨਾ ਹੋਵੇ ਕਿਉਂਕਿ ਅੱਜ ਕੱਲ੍ਹ ਦੇ ਜ਼ਿਆਦਾ ਤੋਂ ਜ਼ਿਆਦਾ ਕੰਮ ਸਮਾਰਟ ਫੋਨ ਰਾਹੀਂ ਕੀਤੇ ਜਾਂਦੇ ਹਨ ਅਤੇ ਇਹ ਸਭ ਕੋਲ ਹੋਣਾ ਅੱਜ ਕੱਲ੍ਹ ਲਾਜ਼ਮੀ ਜਿਹਾ ਹੀ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਕੋਈ ਸਾਡੇ ਕੋਲ ਹੋਰ ਵੀ ਕਾਫੀ ਚੀਜ਼ਾਂ ਹੁੰਦੀਆਂ ਜਿਵੇਂ ਕਿ ਸਾਡੇ ਲੈਪਟੋਪ ਹੋ ਗਏ ਕੰਪਿਊਟਰ ਹੋ ਗਿਆ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਬਟ ਜਿਹੜੀ ਉਹਨਾਂ ਦੀ ਚੀ ਉਹਨਾਂ ਦੇ ਕੰਮ ਹੈ ਉਹ ਵੀ ਅੱਧੇ ਤੋਂ ਜ਼ਿਆਦਾ ਅਸੀਂ ਆਪਣੇ ਸਮਾਰਟ ਫੋਨ 'ਤੇ ਹੀ ਕਰ ਲੈਂਦੇ ਹਾਂ ਜਿਹਦੇ ਕਰਕੇ ਇਹਦੀ ਉਹਨਾਂ ਨਾਲੋਂ ਵੀ ਵੱਧ ਸਾਨੂੰ ਲੋੜ ਮਹਿਸੂਸ ਹੁੰਦੀ ਹੈ